ਮੈਂ ਵੀਡੀਓ ਗੇਮ ਬਾਰੇ ਕਾਫੀ ਕੁਛ ਜਾਣਦਾ ਹਾਂ ਅਤੇ ਉਹ ਮੇਰੇ ਲਈ ਇੱਕ ਸ਼ੌਕ ਹੈ ਮੈਂ ਬਚਪਨ ਤੋਂ ਹੀ ਵੀਡੀਓ ਗੇਮਸ ਵਿੱਚ ਇੰਟਰਸਟਡ ਹਾਂ ਅਤੇ ਉਹ ਮੇਰੇ ਲਈ ਇੱਕ ਕ੍ਰਿਏਟਿਵ ਆਊਟਲੈਟ ਹਾਂ ਜਿੱਥੇ ਮੈਂ ਆਪਣੇ ਇਮੈਜੀਨੇਸ਼ਨ ਨੂੰ ਐਕਸਪਲੋਰ ਕਰ ਸਕਦਾ ਹਾਂ ਮੈਂ ਕਈ ਕਿਸਮ ਦੇ ਵੀਡੀਓ ਗੇਮਸ ਖੇਡ ਚੁੱਕਿਆ ਹਾਂ ਜਿਵੇਂ ਕਿ ਐਕਸ਼ਨ ਅਡਵੈਂਚਰ ਗੇਮਸ ਰੋਲ ਪਲੇਇੰਗ ਗੇਮਸ ਸਟਰੈਟਜੀ ਗੇਮਸ ਪਜ਼ਲ ਗੇਮਸ ਅਤੇ ਸਪੋਰਟਸ ਗੇਮਸ ਮੈਨੂੰ ਵੀਡੀਓ ਗੇਮਸ ਦੀ ਕ੍ਰੀਏਟੀਵਿਟੀ ਅਤੇ ਇਨੋਵੇਸ਼ਨ ਬਹੁਤ ਪਸੰਦ ਹੈ ਹਰ ਇੱਕ ਗੇਮ ਇੱਕ ਨਵੀਂ ਦੁਨੀਆ ਬਣਾਉਂਦਾ ਹੈ ਜਿੱਥੇ ਖਿਲਾੜੀ ਨੂੰ ਐਕਸਪਲੋਰ ਕਰਨਾ ਪੈਂਦਾ ਹੈ ਮੈਨੂੰ ਗੇਮਸ ਦੀ ਗ੍ਰਾਫਿਕਸ ਅਤੇ ਸਾਊਂਡ ਡਿਜ਼ਾਇਨ ਵੀ ਬਹੁਤ ਪਸੰਦ ਹੈ ਜੋ ਖਿਲਾੜੀ ਨੂੰ ਉਹ ਰੀਅਲ ਲਾਈਫ ਐਕਸਪੀਰੀਅਸ ਪ੍ਰੋਵਾਈਡ ਕਰਦੇ ਹੈ ਮੈਂ ਵੀਡੀਓ ਗੇਮਸ ਖੇਡਣ ਤੋਂ ਵਿੱਚ ਉਹ ਮੇਰੇ ਲਈ ਸਟਰੈਸ ਰਿਲੀਵਰ ਹੈ ਜਦੋਂ ਮੈਂ ਥੱਕ ਜਾਂਦਾ ਹਾਂ ਜਾਂ ਥੋੜ੍ਹਾ ਸਟਰੈਸ ਫੀਲ ਕਰਦਾ ਹਾਂ ਮੈਨੂੰ ਵੀਡੀਓ ਗੇਮਸ ਖੇਡ ਕੇ ਆਪਣੇ ਮਾਇੰਡ ਨੂੰ ਰਿਲੈਕਸ ਕਰਦਾ ਹਾਂ ਗੇਮਸ ਖੇਡਣ ਤੋਂ ਵਿੱਚ ਮੈਂ ਆਪਣੇ ਫਰੈਂਡਸ ਨਾਲ ਵੀ ਕਨੈਕਟ ਹੋ ਜਾਂਦਾ ਹਾਂ ਅਤੇ ਉਹਨਾਂ ਨਾਲ ਕੋਂਪੀਟੀਸ਼ਨ ਵੀ ਆਉਂਦਾ ਮੇਰੇ ਲਈ ਬਹੁਤ ਇੰਜੋਏਬਲ ਹੈ ਆਖਰੀ ਗੱਲ ਮੈਂ ਵੀਡੀਓ ਗੇਮਸ ਦੀ ਸਟੋਰੀ ਟੈਲਿੰਗ ਦਾ ਬਹੁਤ ਸ਼ੌਕ ਰੱਖਦਾ ਹਾਂ ਕੁਝ ਗੇਮਸ ਦੀਆਂ ਕਹਾਣੀਆਂ ਇੰਨੀਆਂ ਅਗੇਜਿੰਗ ਹੈ ਕਿ ਉਹਨਾਂ ਵਿੱਚ ਡੋਬੀਆਂ ਜਾਣ ਨੂੰ ਨਾਲ ਲੈ ਕੇ ਜਾਂਦੀਆਂ ਹਨ